ਮੈਂ ਪਿੰਡ ਹੰਡਿਆਇਆ ਜ਼ਿਲ੍ਹਾ ਬਰਨਾਲਾ ਦੀ ਵਸਨੀਕ ਹਾਂ ਮੈਂ ਤੁਹਾਨੂੰ ਦੱਸਣਾ ਚਾਹੁੰਦੀ ਹਾਂ ਕਿ ਸਾਡੇ ਵੱਖ ਵੱਖ ਕਾਰਨ ਹਨ ਜਿਹਨਾਂ ਕਾਰਨ ਸਾਡੇ ਪਿੰਡ ਦੇ ਬਜ਼ੁਰਗ ਮੰਜੇ 'ਤੇ ਹੀ ਪਾਏ ਰਹਿੰਦੇ ਹਨ ਮੰਜੇ 'ਤੇ ਪੈਣ ਦਾ ਮੇਨ ਕਾਰਨ ਸਿਹਤ ਨੂੰ ਲੈ ਕੇ ਹੈ ਜਿੱਦਾਂ ਅਸੀਂ ਆਉਣ ਵਾਲੀ ਪੀੜ੍ਹੀ ਖ਼ਤਰੇ ਵਿੱਚ ਜਾ ਰਹੀ ਹੈ ਉਸ ਤਰ੍ਹਾਂ ਹੀ ਬਜ਼ੁਰਗ ਮੰਜੇ ਤਾਂ ਪਹਿਲਾਂ ਸੱਤਾਂ ਚੌਂਕਾਂ 'ਚ ਬੈਠੇ ਰਹਿੰਦੇ ਸੀ ਹੁਣ ਇਹ ਮੇਨ ਕ ਕਾਰਨ ਇਸ ਦਾ ਇਹ ਬਣਦਾ ਹੈ ਕਿ ਆਪਾਂ ਕਸਰਤ ਨਹੀਂ ਕਰਦੇ ਅਤੇ ਸਾਰਾ ਦਿਨ ਮੰਜੇ 'ਤੇ ਪਏ ਰਹਿੰਦੇ ਹਾਂ ਤਾਂ ਇਸ ਕਾਰਨ ਸਾਨੂੰ ਕਈ ਬਿਮਾਰੀਆਂ ਅੱਗੇ ਚਿਮਟ ਜਾਂਦੀਆਂ ਹਨ ਜਿਸ ਨਾਲ ਅਸੀਂ ਕਈ ਰੋਗਾਂ ਦਾ ਸਾਹਮਣਾ ਕਰਨ ਲੱਗ ਜਾਂਦੇ ਹਾਂ ਸਾਨੂੰ ਆਪਣੀ ਸਿਹਤ ਦਾ ਧਿਆਨ ਰੱਖਣ ਦਾ ਬਹੁਤ ਜ਼ਰੂਰੀ ਹੈ ਸਾਨੂੰ ਡੇਲੀ ਕਸਰਤ ਕਰਨੀ ਚਾਹੀਦੀ ਹੈ ਯੋਗਾ ਕਰਨਾ ਚਾਹੀਦੀ ਹੈ ਤਾਂ ਕਿ ਅਸੀਂ ਆਪਣੀ ਸਿਹਤ ਨੂੰ ਵਧੀਆ ਬਣਾਈ ਰੱਖੀਏ ਜੇਕਰ ਸਾਡੀ ਸਿਹਤ ਵਧੀਆ ਹੋਵੇਗੀ ਤਾਂ ਹੀ ਅਸੀਂ ਕੋਈ ਕੰਮ ਕਰ ਸਕਦੇ ਹਾਂ ਤਾਂ ਹੀ ਅਸੀਂ ਕੋਈ ਹੋਰ ਕੰਮ ਕਰ ਸਕਦੇ ਹਾਂ ਸਾਨੂੰ ਸਭ ਤੋਂ ਪਹਿਲਾਂ ਸਿਹਤ ਵੱਲ ਧਿਆਨ ਦੇਣਾ ਜ਼ਰੂਰੀ ਹੈ ਸਾਡਾ ਇੱਕ ਪਿੰਡ ਦਾ ਬਜ਼ੁਰਗ ਜੋ ਕਿ ਪਹਿਲਾਂ ਚਪੜਾਸੀ ਸੀ ਹੁਣ ਉਹ ਲਿਟਾਇਰ ਹੋ ਚੁੱਕਿਆ ਹੈ ਹੁਣ ਉਹ ਬਹੁਤ ਹੀ ਬਿਮਾਰ ਰਹਿਣ ਲੱਗ ਗਿਆ ਹੈ ਕਿਉਂਕਿ ਜਿਸ ਤਰ੍ਹਾਂ ਉਹ ਪਹਿਲਾਂ ਕੰਮ ਵਿੱਚ ਲੱਗਿਆ ਰਹਿੰਦਾ ਸੀ ਤਾਂ ਉਸਨੂੰ ਕੋਈ ਵੀ ਬਿਮਾਰੀ ਨਹੀਂ ਸੀ ਹੁਣ ਜਿੱਦਾਂ ਵੀ ਉਹ ਘਰ ਰਹਿਣ ਲੱਗ ਗਿਆ ਉਸ ਨੂੰ ਕਈ ਬਿਮਾਰੀਆਂ ਦਾਂ ਸਾਹਮਣਾ ਕਰਨਾ ਪੈ ਰਿਹਾ ਹੈ ਅਤੇ ਉਹ ਕਈ ਰੋਗਾਂ ਨਾਲ ਸਿਮਟ ਰਿਹਾ ਹੈ ਉਸਦੇ ਪਰਿਵਾਰ ਦੇ ਮੈਂਬਰ ਉਸ ਨਾਲ ਬਹੁਤ ਹੀ ਵਧੀਆ ਦੇਖਭਾਲ ਕਰ ਰਹੇ ਸਨ ਉਸ ਦੇ ਪਰਿਵਾਰ ਦੇ ਮੈਂਬਰ ਉਸ ਦੀ ਸ ਉਸ ਉਸਦੀ ਵਾਈਫ਼ ਉਸਦੇ ਬੱਚੇ ਉਸ ਉਸ ਦੇ ਬੱਚੇ ਪੋਤਰੇ ਸਾਰੇ ਹੀ ਉਸ ਦੀ ਸੇਵਾ ਵਿੱਚ ਲੱਗੇ ਹੁੰਦੇ ਹਨ ਅਤੇ ਉਸਦੀ ਦੇਖਭਾਲ ਦਾ ਬਹੁਤ ਹੀ ਧਿਆਨ ਰੱਖਦੇ ਹਨ ਉਸਨੂੰ ਵਧੀਆ ਤਰੀਕੇ ਨਾਲ ਨਿਭਾਉਂਦੇ ਹਨ ਉਹ ਆਪਣੇ ਸ ਪਰਿਵਾਰ ਨੂੰ ਇੱਕ ਵੱਡਾ ਮੈਂਬਰ ਸਮਝ ਕੇ ਉਸਦੀ ਦੇਖਭਾਲ ਕਰਦੇ ਹਨ ਉਹ ਉਸਨੂੰ ਇਕੱਲਾ ਮਹਿਸੂਸ ਨਹੀਂ ਹੋਣ ਦਿੰਦੇ ਉਸ ਦੀ ਹਰ ਇੱਕ ਲੋੜ ਨੂੰ ਪੂਰੀ ਕਰਦੇ ਹਨ ਜਿਹੜੀ ਲੋੜ ਦੀ ਜਿਹੜੀ ਜ਼ਰੂਰਤ ਜਿਹੜੀ ਚੀਜ਼ ਦੀ ਉਸ ਨੂੰ ਜ਼ਰੂਰਤ ਹੈ ਉਸ ਨੂੰ ਮੌਕੇ 'ਤੇ ਹਾਜ਼ਰ ਕਰਦੇ ਹਨ